ਹੈਲੋ ਤੁਸੀਂ ਗੁਰੂ ਨਾਨਕ ਕੋਲਜ ਤੋਂ ਬੋਲਦੇ ਹੋ ਜੀ ਇਹ ਮੈਂ ਇੱਥੇ ਐਡਮਿਸ਼ਨ ਵ ਲੈਣੀ ਸੀਗੀ ਅਤੇ ਤੁਸੀਂ ਮੈਨੂੰ ਇੱਕ ਕੋਲਜ ਬਾਰੇ ਅਤੇ ਇਨਵਾਇਰਮੈਂਟ ਬਾਰੇ ਦੱਸ ਸਕਦੇ ਹੋ ਓਕੇ ਜੀ ਠੀਕ ਹੈ ਜੀ ਐਕਚੁਲੀ ਮੈਂ ਵੀ ਬਈ ਆਪਣੀ ਜਿਹੜੀ ਹੈਗੀ ਆ ਬੀ ਏ ਇੱਥੋਂ ਕਰਨਾ ਚਾਹੁੰਦੀ ਹਾਂ ਮੈਂ ਇਸ ਕਾਲਜ ਬਾਰੇ ਸੁਣਿਆ ਸੀਗਾ ਵੀ ਮੈਂ ਇੱਥੇ ਨਹੀਂ ਰਹਿੰਦੀ ਮੈਂ ਇਸ ਸਾਈਡ ਵੀ ਕਿਸੇ ਹੋਰ ਸਟੇਸ਼ਨ ਤੋਂ ਆ ਰਹੀ ਹਾਂ ਮੈਂ ਇੱਧਰੋਂ ਆ ਰਹੀ ਹਾਂ ਫਿਰੋਜਪੁਰ ਤੋਂ ਆ ਰਹੀ ਹਾਂ ਅਤੇ ਇੱਥੇ ਜਿਹੜੀ ਬੀ ਏ ਆ ਓਹ ਬਈ ਜਿਹੜੇ ਹੈਗੇ ਟੀਚਰਸ ਉਹਨਾਂ ਦਾ ਜਿਹੜਾ ਸਟੂਡੈਂਟ ਨਾਲ ਕੋਪਰੇਟ ਕਿਵੇਂ ਆ ਵਧੀਆ ਹੈਗਾ ਠੀਕ ਹੈ ਜੀ ਠੀਕ ਹੈ ਜੀ ਅਤੇ ਜਿਹੜਾ ਇੱਥੇਥੇ ਹੋ ਹੋਸਟਲ ਦੀ ਜਿਹੜੀ ਹੈਗੀ ਆ ਜੇ ਹੈਗੀ ਸੁਵਿਧਾ ਹੋਸਟਲ ਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਇੱਕ ਰੂਮ ਇੱਕ ਜਣੇ ਨੂੰ ਮਿਲਦਾ ਕਿ ਕਿਸੇ ਨਾਲ ਜੁਇੰਟ ਵੀ ਕਰਨਾ ਪੈਂਦਾ ਹੈ ਠੀਕ ਹੈ ਜੀ ਤੁਸੀਂ ਜੀ ਜਿਵੇਂ ਇੱਥੇ ਹੋਸਟਲ ਵਗੈਰਾ ਰਹਿੰਦੇ ਜਾਂ ਤੁਸੀਂ ਅੱਪ ਡਾਊਨ ਕਰਦੇ ਹੋ ਤੁਸੀਂ ਡਾਊਨ ਕਰਦੇ ਹੋ

ਹਾਂਜੀ ਅਤੇ ਐਡਮਿਸ਼ਨ ਵਗੈਰਾ ਦਾ ਫੀਸ ਵਗੈਰਾ ਮੈਨੂੰ ਦੱਸ ਸਕਦੇ ਹੋ ਕਿ ਕਿੰਨੀ ਹੋ ਸਕਦੀ ਹੈ ਇੱਕ ਸਮੈਸਟਰ ਦੀ ਠੀਕ ਹੈ ਜੀ

ਠੀਕ ਹੈ ਜੀ ਅਤੇ ਇੱਥੇ ਵੀ ਹੋਟਲ ਵਗੈਰਾ ਵੀ ਜਦੋਂ ਆਪਾਂ ਆਉਂਦੇ ਹਾਂ ਚਾਰ ਸਾਹਿਬ ਬਸ ਵਗੈਰਾ ਕੋਈ ਆਟੋ ਵਗੈਰਾ ਮਿਲ ਜਾਂਦੇ ਆ ਅਰਾਮਦਾਰੀ ਨਾਲ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਜੀ ਠੀਕ ਹੈ ਜੀ ਅਤੇ ਇਸ ਤੋਂ ਇਲਾਵਾ ਹਾਂਜੀ ਹਾਂਜੀ

ਹਾਂਜੀ ਪਲੀਜ਼ ਮੈਨੂੰ ਮਿਲ ਲਿਓ ਅਤੇ ਬਾਕੀ ਮੇਰੇ ਐਡਮਿਸ਼ਨ ਕਰਵਾਉਣ ਦੇ ਵਿੱਚ ਵੀ ਮੇਰੇ ਹੈਲਪ ਕਰਾ ਦਿਓ ਤਾਂ ਮੈਨੂੰ ਥੋੜ੍ਹਾ ਜਿਹਾ ਸੌਖਾ ਹੋ ਜੇਗਾ ਹਾਂਜੀ ਓਕੇ ਜੀ ਥੈਂਕ ਯੂ ਜੀ